ਟੈਕਨੋਲਜੀ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਹੱਦ ਤੱਕ ਬਦਲਿਆ ਜਿੱਦਾਂ ਸਮਾਰਟਫੋਨ ਇੰਟਰਨੈੱਟ ਦੀ ਵਰਤੋਂ ਨਾਲ ਅਸੀਂ ਬਹੁਤ ਜ਼ਿਆਦਾ ਅ ਆਪਣੀ ਜ਼ਿੰਦਗੀ ਨੂੰ ਅੱਗੇ ਲੈ ਕੇ ਜਾ ਜਾ ਸਕੇ ਹਾਂ ਬਹੁਤ ਸਾਰੀਆਂ ਰੋਜ਼ਮਰਾਂ ਦੀਆਂ ਖ਼ਬਰਾਂ ਤੋਂ ਅਸੀਂ ਜਾਣੂ ਹੁੰਦੇ ਹਾਂ ਪੜ੍ਹਾਈ ਦੀ ਪੜ੍ਹਾਈ ਦੀ ਵਰਤੋਂ ਵਿੱਚ ਸਾਡੀ ਮਦਦ ਹੁੰਦੀ ਹੈ ਦੂਰ ਦੁਰੇਡੇ ਰਿਸ਼ਤੇਦਾਰਾਂ ਤੋਂ ਨਾਲ ਬੈਠੇ ਹੋਏ ਭਾਈਚਾਰੇ ਨਾਲ ਅਸੀਂ ਆਪਣੀ ਗੱਲਬਾਤ ਕਰ ਸਕਦੇ ਹਾਂ ਗੱਲਬਾਤ ਕਰ ਸਕਦੇ ਹਾਂ ਉਹਨਾਂ ਨੂੰ ਉਹਨਾਂ ਦੀ ਰੋਜ਼ਮਰਾਂ ਦੀ ਜ਼ਿੰਦਗੀ ਬਾਰੇ ਆਪਣੀ ਬਾਰੇ ਦੱਸ ਸਕਦੇ ਹਾਂ ਪੁਰਾਣੀ ਟੈਕਨੋਲਜੀ ਤੋਂ ਨਵੀਂ ਟੈਕਨੋਲਜੀ ਨਾਲ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੀ ਵਰਤੋਂ ਹੋਈ ਵਰਤੋਂ ਨਵੀਂ ਆਈ ਹੈ ਅਤੇ ਟੈਕਨੋਲਜੀ ਦੇ ਕਾਰਨ ਨਾਲ ਜਿਹੜੀਆਂ ਸਾਡੀਆਂ ਚੀਜ਼ਾਂ ਆਸਾਨ ਹੋਈਆਂ ਜਿਵੇਂ ਹੋਟਲ ਦੀ ਬੁਕਿੰਗ ਕਰਨਾ ਬੈਂਕਿੰਗ ਭੁਗਤਾਨ ਖਰੀਦਦਾਰੀ ਕਿਸੇ ਵੀ ਚੀਜ਼ ਬਾਰੇ ਨਵੀਂ ਤੋਂ ਨਵੀਂ ਜਾਣਕਾਰੀ ਲੈਣ ਨਾਲ ਲੈਣ ਦੇਣ ਨਾਲ ਸਾਡੀ ਜ਼ਿੰਦਗੀ ਬਹੁਤ ਆਸਾਨ ਹੋਈ ਹੈ